ਬੈਂਕਾਂ ਵਿੱਚ ਅਤੇ ਬੀਮਾ ਕੰਪਨੀਆਂ ਵਿੱਚ ਅੱਜ ਕੱਲ੍ਹ ਸਭ ਕੁਛ ਹੀ ਡਿਜੀਟਲ ਹੋ ਗਿਆ ਹੈ ਪਹਿਲਾਂ ਸਾਨੂੰ ਹਰ ਕੰਮ ਲਈ ਬੈਂਕਾਂ 'ਚ ਜਾਣਾ ਪੈਂਦਾ ਸੀ ਪਰ ਹੁਣ ਬੈਂਕ ਵਾਲਿਆਂ ਨੇ ਸਭ ਕੁਛ ਹੀ ਆਨਲਾਈਨ ਕਰਤਾ ਹੈ ਹਰ ਬੈਂਕ ਦੀ ਆਪਣੀ ਇੱਕ ਐਪ ਹੈ ਅਤੇ ਐਪ ਵਿੱਚ ਅਸੀਂ ਜਿਹੜੀ ਵੀ ਜਾਣਕਾਰੀ ਲੈਣਾ ਚਾਹੁੰਦੇ ਹਾਂ ਉਹ ਅਸੀਂ ਆਪਣੀ ਐਪ ਤੋਂ ਲੈ ਸਕਦੇ ਹਾਂ ਹੋਰ ਤਾਂ ਹੋਰ ਸਾਡੇ ਬੈਂਕ ਦੀ ਵੈਬਸਾਈਟ 'ਤੇ ਜਾ ਕੇ ਸਾਡਾ ਅਕਾਊਂਟ ਬਣਿਆ ਹੁੰਦਾ ਹੈ ਉੱਥੇ ਆਪਾਂ ਕੋਈ ਵੀ ਜਾਣਕਾਰੀ ਲੈ ਸਕਦੇ ਹਾਂ ਜਾਂ ਅਗਰ ਆਪਾਂ ਆਨਲਾਈਨ ਟ੍ਰਾਂਸਫਰ ਕਰਨਾ ਹੈ ਤਾਂ ਉਹ ਵੀ ਅਸੀਂ ਘਰ ਬੈਠ ਕੇ ਕਰ ਸਕਦੇ ਹਾਂ ਅਤੇ ਫਿਨਟੈਕ ਵਰਗੇ ਸੋਫਟਵੇਅਰ ਨੇ ਇਹ ਕੰਮ ਸਾਡੇ ਲਈ ਹੋਰ ਆਸਾਨ ਕਰ ਦਿੱਤਾ ਹੈ ਅਤੇ ਰਹੀ ਗੱਲ ਬੈਂਕਾਂ ਇੰਸ਼ੋਰੈਂਸ ਦੀ ਅਤੇ ਪਹਿਲਾਂ ਸਾਨੂੰ ਫਾਈਨੈਂਸ ਕਰਵਾਉਣ ਲਈ ਜਿਵੇਂ ਮੰਨ ਲਓ ਅਸੀਂ ਗੱਡੀ ਲੈਣੀ ਆ ਤਾਂ ਫਾਈਨੈਂਸ ਕਰਵਾਉਣ ਲਈ ਸਾਨੂੰ ਬੈਂਕ ਕੋਲ ਜਾਣਾ ਪੈਂਦਾ ਸੀ ਅਤੇ ਉਸ ਗੱਡੀ ਦੀ ਇਨਸ਼ੋਰੈਂਸ ਕਰਵਾਉਣ ਲਈ ਸਾਨੂੰ ਇੰਸ਼ੋਰੈਂਸ ਕੰਪਨੀ ਵੱਲ ਜਾਣਾ ਪੈਂਦਾ ਸੀ ਪਰ ਇਹ ਦੋਨਾਂ ਨੇ ਟਾਈਅਪ ਇਹ ਦੋਨਾਂ ਦਾ ਟਾਈਅਪ ਹੋਣ ਤੋਂ ਬਾਅਦ ਇੱਕੋ ਹੀ ਥਾਂ 'ਤੇ ਸਾਡੇ ਫਾਇਨੈਂਸ ਵੀ ਹੋ ਜਾਂਦਾ ਹੈ ਅਤੇ ਸਾਡੀ ਇਨਸ਼ੋਰੈਂਸ ਵੀ ਹੋ ਜਾਂਦੀ ਹੈ ਅਤੇ ਇਹ ਸਾਰੀ ਵਿਕਾਸ ਨੇ ਸਾਡਾ ਕੰਮ ਹੋਰ ਵੀ ਆਸਾਨ ਕਰ ਦਿੱਤਾ ਹੈ